ਅੱਜ ਦੀਆਂ ਬਦਲਦੀਆਂ ਤਕਨੀਕੀਆਂ ਤਰੱਕੀਆਂ ਨਾਲ ਜੁੜੇ ਰਹਿਣ ਲਈ ਸਾਡੇ ਕੋਲ ਬਹੁਤ ਸਾਧਨ ਹਨ ਜਿਵੇਂ ਕਿ ਮੋਬਾਈਲ ਫੋਨ ਕੰਪਿਊਟਰ ਲੈਪਟੋਪ ਟੈਬਲੇਟਸ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਸਾਨੂੰ ਬਦਲਦੀਆਂ ਤਰੱਕੀਆਂ ਨਾਲ ਜੋੜੀ ਰੱਖਦੀ ਹੈ ਮੈਂ ਮੋਬਾਈਲ ਫੋਨ ਅਤੇ ਕੰਪਿਊਟਰ ਇੱਕ ਕੋਚਿੰਗ ਸੈਂਟਰ ਤੋਂ ਸਿੱਖਿਆ ਸੀ ਮੇਰੇ ਮਾਪਿਆਂ ਨੇ ਮੈਨੂੰ ਉੱਥੇ ਪੰਦਰ੍ਹਾਂ ਦਿਨਾਂ ਦੇ ਕੋਰਸ ਨੂੰ ਜੁਆਇਨ ਕਰਨ ਲਈ ਕਿਹਾ ਅਤੇ ਮੈਂ ਕੀਤਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੰਪਿਊਟਰ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਇੱਕ ਮਨੁੱਖ ਅੱਗੇ ਵੱਧ ਹੀ ਨਹੀਂ ਸਕਦਾ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਇਹ ਜਿਹੜੀਆਂ ਜਿਵੇਂ ਕਿ ਕੈਲਕੂਲੇਸ਼ਨ ਨੂੰ ਜਾਂ ਹੋਰ ਕਈ ਚੀਜ਼ਾਂ ਨੂੰ ਮੈਸੇਜ ਭੇਜਣਾ ਵੀਡੀਓ ਕਾਲਾਂ ਕਰਨੀਆਂ ਉਹਨਾਂ ਚੀਜ਼ਾਂ ਨੂੰ ਸੌਖਾ ਬਣਾ ਦਿੰਦੀ ਹੈ ਅੱਜ ਕੱਲ੍ਹ ਦੇ ਲੋਕਾਂ ਨੂੰ ਇਹਦੀ ਸਿਖਲਾਈ ਬਹੁਤ ਜ਼ਰੂਰੀ ਹੈ ਇਹਨੂੰ ਚਲਾਉਣਾ ਅੱਜ ਕੱਲ੍ਹ ਫਾਈਵ ਜੀ ਦਾ ਜ਼ਮਾਨਾ ਹੈ ਲੋਕ ਇੱਕ ਦੂਜੇ ਨਾਲ ਸੰਪਰਕ ਬਹੁਤ ਜਲਦੀ ਕਰ ਸਕਦੇ ਹਨ ਮੋਬਾਈਲ ਫੋਨ ਜਾਂ ਕੰਪਿਊਟਰ ਦੇ ਥਰੂ ਇਸ ਲਈ ਇਹਦੀ ਸਿੱਖਿਆ ਬਹੁਤ ਜ਼ਰੂਰੀ ਹੈ ਮੈਂ ਇੱਕ ਕੋਚਿੰਗ ਸੈਂਟਰ ਤੋਂ ਇਹਦੀ ਸਿੱਖਿਆ ਲਈ ਸੀ ਅਤੇ ਇਹ ਬਦਲਦੀਆਂ ਤਕਨੀਕੀਆਂ ਨਾਲ ਆਪਣੇ ਆਪ ਨੂੰ ਜੋੜਨ ਦੇ ਬਹੁਤ ਤਰੀਕੇ ਹਨ ਬਹੁਤ ਸਾਰੇ ਸੈਂਟਰ ਖੁੱਲ੍ਹੇ ਹਨ ਬਹੁਤ ਸਾਰੇ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਸਮਾਰਟ ਕਲਾਸਾਂ ਦੇ ਥਰੂ ਇਹਨਾਂ ਚੀਜ਼ਾਂ ਨਾਲ ਜੋੜੀ ਰੱਖਣ ਦੀਆਂ ਤਕਨੀਕੀਆਂ ਸਿਖਾਈਆਂ ਜਾਂਦੀਆਂ ਹਨ ਅਤੇ ਸਿਖਲਾਈ ਦਿੱਤੀ ਜਾਂਦੀ ਹੈ